ਗਰਮੀਆਂ ਵਿੱਚ ਕੱਪੜੇ ਅਸੀਂ ਹੱਥ ਨਾਲ ਧੋ ਕੇ ਅਤੇ ਬਾਹਰ ਧੁੱਪ ਵਿੱਚ ਸੁਕਾ ਸਕਦੇ ਹਾਂ ਜਿਸ ਨਾਲ ਅਸੀਂ ਕ ਮੌਸਮ ਦੇ ਅਨੁਸਾਰ ਕੱਪੜੇ ਗਰਮੀਆਂ ਵਿੱਚ ਜਲਦੀ ਸੁੱਕ ਜਾਂਦੇ ਹਨ ਅਗਲਾ ਬਰਸਾਤ ਦੇ ਮੌਸਮ ਵਿੱਚ ਕੱਪੜੇ ਜਲਦੀ ਨਹੀਂ ਸੁੱਕਦੇ ਇਸ ਕਰਕੇ ਉਹਨਾਂ ਨੂੰ ਵਾਸ਼ਿੰਗ ਮਸ਼ੀਨ ਵਿੱਚ ਧੋ ਕੇ ਅਤੇ ਸੁਕਾਇਆ ਜਾਂਦਾ ਹੈ ਜਿਸ ਨਾਲ ਕੱਪੜਿਆਂ ਨੂੰ ਸੁੱਕਣ ਵਿੱਚ ਕੋਈ ਵੀ ਮੁਸ਼ਕਿਲ ਨਹੀਂ ਆਉਂਦੀ ਸਰਦੀਆਂ ਦੇ ਮੌਸਮ ਵਿੱਚ ਅਸੀਂ ਵਾਸ਼ਿੰਗ ਮਸ਼ੀਨ ਵਿੱਚ ਹੀ ਕੱਪੜੇ ਧੋਂਦੇ ਹਾਂ ਕਿਉਂਕਿ ਸਾਨੂੰ ਕੱਪੜੇ ਸੁਕਾਉਣ ਵਿੱਚ ਬਹੁਤ ਮੁਸ਼ਕਿਲ ਆਉਂਦੀ ਹੈ ਵਾਸ਼ਿੰਗ ਮਸ਼ੀਨ ਦੇ ਨਾਲ ਸਾਨੂੰ ਬਹੁਤ ਆਸਾਨ ਹੋ ਗਿਆ ਹੈ ਕਿ ਅਸੀਂ ਕੱਪੜੇ ਧੋ ਵੀ ਥੋੜ੍ਹੇ ਟਾਈਮ ਵਿਚ ਸਕਦੇ ਹਾਂ ਅਤੇ ਜਲਦੀ ਸੁਕਾ ਵੀ ਸਕਦੇ ਹਾਂ ਇਸ ਕਰਕੇ ਇਸ ਦੇ ਯੁਗ ਇਸ ਅੱਜ ਦੇ ਯੁਗ ਵਿੱਚ ਕੱਪੜੇ ਮਸ਼ੀਨ ਨਾਲ ਹੀ ਧੋਤੇ ਜਾਂਦੇ ਹਨ ਵਾਸ਼ਿੰਗ ਮਸ਼ੀਨ ਦੇ ਨਾਲ ਧੋ ਕੇ ਸਾਡਾ ਕਾਫ਼ੀ ਸਮਾਂ ਵੀ ਬਚ ਜਾਂਦਾ ਹੈ ਅਤੇ ਸਾਨੂੰ ਬਹੁਤੀ ਮਿਹਨਤ ਵੀ ਨਹੀਂ ਕਰਨੀ ਪੈਂਦੀ ਪਹਿਲੇ ਯੁੱਗ ਵਿੱਚ ਸਾਨੂੰ ਬਹੁਤ ਮੁਸ਼ਕਿਲਾਂ ਆਉਂਦੀਆਂ ਸੀ ਕਿਉਂਕਿ ਸਾਨੂੰ ਕੱਪੜੇ ਸੁਕਾਉਣ ਵਿੱਚ ਬਹੁਤ ਟਾਈਮ ਲੱਗਦਾ ਸੀ ਜ਼ਿਆਦਾ ਟਾਈਮ ਲੱਗਦਾ ਸੀ ਅਤੇ ਸਾਡੇ ਕੋਲ ਕੱਪੜੇ ਪਾਉਣਾ ਮੁਸ਼ਕਿਲ ਲੱਗਦਾ ਸੀ ਇਸ ਕਰਕੇ ਅੱਜ ਕੱਲ੍ਹ ਕੱਪੜੇ ਧੋਣੇ ਅਤੇ ਸੁਕਾਉਣੇ ਬਹੁਤ ਹੀ ਸੌਖੇ ਹੋ ਗਏ ਹਨ